ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਬੀ ਐਸ ਐਨ ਐਲ ਸੇਵਾ ਕੇਂਦਰ 'ਚੋਂ ਬੋਲ ਰਹੇ ਹੋ ਹਾਂਜੀ ਸਰ ਅਸੀਂ ਬਰਨਾਲਾ ਡਿਸਟਰਿਕਟ ਤੋਂ ਬੋਲ ਰਹੇ ਹਾਂ ਹਾਂਜੀ ਸਰ ਸਾਡੇ ਘਰ ਨਾ ਜੀ ਮਿਸਤਰੀ ਲੱਗਿਆ ਹੋਇਆ ਸੀ ਉਹਨਾਂ ਤੋਂ ਗਲਤੀ ਦੇ ਨਾਲ ਤਾਰਾਂ ਕੱਟੀਆਂ ਗਈਆਂ ਹਾਂਜੀ ਮਿਸਤਰੀ ਚਲਾ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਲੇਬਰ ਵਾਲੇ ਬੰਦੇ ਸੀਗੇ ਉਹਨਾਂ ਨ ਤੋਂ ਖੰਭਾ ਡਿੱਗ ਗਿਆ ਜੀ ਤਾਰਾਂ 'ਤੇ ਉਸ ਕਰਕੇ ਜਿਹੜਾ ਸਾਡੇ ਗਲੀ ਦੇ ਵਿੱਚ ਜਿੰਨੇ ਵੀ ਘਰ ਸੀਗੇ ਉਹਨਾਂ ਦਾ ਸਾਰਿਆਂ ਦਾ ਇੰਟਰਨੈਟ ਕਨੈਕਸ਼ਨ ਸਾਰਾ ਕੁਛ ਕੱਟਿਆ ਗਿਆ ਜੀ ਉਸ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਨੂੰ ਫੇਸ ਕਰਨਾ ਪੈ ਰਿਹਾ ਹੈਗਾ ਅਤੇ ਸਰ ਅਸੀਂ ਤੁਹਾਨੂੰ ਫੋਨ ਵੀ ਹੁਣ ਬਹੁਤ ਦੂਰ ਜਾ ਕੇ ਕਿਤੋਂ ਕੀਤਾ ਹੈਗਾ ਹਾਂਜੀ ਸਰ ਉਸ ਕਰਕੇ ਤੁਹਾਨੂੰ ਰਿਕੁਐਸਟ ਹੈ ਜੀ ਵੀ ਤੁਹਾਡੀ ਟੀਮ ਨੂੰ ਕਿਹਾ ਜਾਵੇ ਵੀ ਸਾਡੀ ਗਲੀ ਦੇ ਵਿੱਚ ਜਿਹੜੀਆਂ ਤਾਰਾਂ ਟੁੱਟੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਤਾਂ ਕਿ ਅਸੀਂ ਸਾਰੇ ਗਲੀ ਦੇ ਜਿੰਨੇ ਹੈਗੇ ਐਂਗੇ ਉਹਨਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਸਰ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਹਾਂਜੀ ਸਰ ਅਸੀਂ ਦੇਖੋ ਸਰ ਐਂ ਹੈਗੇ ਜੀ ਆਨਲਾਈਨ ਕੰਮ ਕਰਨਾ ਹੁੰਦਾ ਹੈਗਾ ਬੱਚੇ ਬਾਹਰ ਬੈਠੇ ਨੇ ਉਹਨਾਂ ਨਾਲ ਗੱਲ ਵੀ ਕਰਨੀ ਹੈ ਇਸ ਕਰਕੇ ਉਹਨਾਂ ਦੇ ਫੋਨ ਆਉਂਦੇ ਨੇ ਸਰ ਅਸੀਂ ਫੋਨ ਨਹੀਂ ਚੱਕ ਸਕਦੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਸਾਨੂੰ ਇਸ ਮੁਸੀਬਤ 'ਚੋਂ ਕੱਢੋ ਜੀ ਅਸੀਂ ਤੁਹਾਨੂੰ ਆਨਲਾਈਨ ਵੀ ਰਿਕੁਐਸਟ ਪਾ ਦਿੱਤੀ ਹੈ ਕੰਪਲੇਂਟ ਕਰਤੀ ਤੁਹਾਨੂੰ ਫੋਨ ਵੀ ਕਰਤਾ ਹਾਂਜੀ ਸਰ ਬਸ ਹੁਣ ਸਾਡੀ ਬੇਨਤੀ ਹੈ ਜੀ ਕਿ ਇਸ ਸਾਡੀ ਰਿਕੁਐਸਟ ਨੂੰ ਜਲਦੀ ਤੋਂ ਜਲਦੀ ਤੁਸੀਂ ਐਕਸੈਪਟ ਕਰੋ ਅਤੇ ਆਪਣੀ ਟੀਮ ਨੂੰ ਕਹੋ ਵੀ ਤੁਸੀਂ ਸਾਡੇ ਘਰ ਆ ਕੇ ਗਲੀ 'ਚ ਆਓ ਅਤੇ ਸਾਡੇ ਇਸ ਪ੍ਰੋਬਲਮ ਦਾ ਹੱਲ ਲੱਭੋ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ ਹਾਂਜੀ ਸਰ ਥੈਂਕ ਯੂ ਸੋ ਮੱਚ